ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਕਿਤਾ ਕੁਮਾਰੀ ਹੈ ਮੈਨੂੰ ਮੇਰੀ ਦੀਦੀ ਨੇ ਤੁਹਾਡਾ ਨੰਬਰ ਦਿੱਤਾ ਹੈ ਤੁਸੀਂ ਤਨੂੰ ਕਲੋਥਸ ਤੋਂ ਬੋਲਦੇ ਹੋ ਮੈਂ ਮੈਨੂੰ ਉਹ ਤੁਹਾਡੀ ਦੁਕਾਨ ਤੋਂ ਕੁਝ ਸਮਾਨ ਚਾਹੀਦਾ ਹੈ ਤੁਹਾਡੇ ਕੋਲ ਪੰਜਾਬੀ ਟ੍ਰੀਡਸ਼ਨਲ ਸਮਾਨ ਹੈਗਾ ਹੈ ਕੀ ਕੀ ਚੀਜ਼ਾਂ ਹੈਗੀਆ ਨੇ

ਅੱਛਾ ਅਤੇ ਜੁੱਤੇ ਵਗੈਰਾ ਸਾਨੂੰ ਚਾਹੀਦੇ ਹੈਗੇ ਅਤੇ ਕੈਂਠੇ ਵਗੈਰਾ ਅਤੇ ਇਹ ਜਿਹੜੇ ਕੁੜਤੇ ਪਜਾਮੇ ਦੇ ਕੱਪੜੇ ਉਹ ਕਿਹੜੇ ਕਿਹੜੇ ਕਲਰ ਦੇ ਹੈ ਹਾਂਜੀ ਅੱਛਾ ਸਾਨੂੰ ਮਤਲਬ ਪੰਜ ਮੀਟਰ ਠੀਕ ਐ ਸਾਨੂੰ ਮਤਲਬ ਪੰਜ ਮੀਟਰ ਚਾਹੀਦੇ ਹੈ ਕੁੜਤੇ ਪਜਾਮੇ ਦੇ ਕੱਪੜੇ ਤੁਸੀਂ ਸਾਨੂੰ ਦੇ ਦਿਓ ਠੀਕ ਹੈ ਜੀ ਵਧੀਆ ਕੁਆਲਟੀ ਦੇ ਹੋਣੇ ਚਾਹੀਦੇ ਹੈ ਮਤਲਬ ਕੋਟਨ ਦਾ ਹੋਣਾ ਚਾਹੀਦਾ ਹੈ ਅੱਛਾ ਜੀ ਕੀ ਕੀ ਲਹਿੰਗੇ ਵਗੈਰਾ ਹੈ ਅਤੇ ਫਿਰ ਸੂਟ ਦਾ ਵੀ ਪੰਜ ਮੀਟਰ ਕਰ ਦਿਓ

ਠੀਕ ਹੈ ਜੀ ਤੁਸੀਂ ਮੈਨੂੰ ਆਪਣਾ ਐਡਰੈਸ ਇੱਕ ਵਾਰੀ ਦੱਸ ਦਿਓ ਵੱਟਸਐਪ ਕਰ ਦਿਓ ਜੀ ਅੱਛਾ ਜੀ ਤੁਸੀਂ ਵੀ ਮੈਨੂੰ ਵੱਟਸਐਪ ਕਰ ਦਿਓ ਐਡਰੈਸ ਵਗੈਰਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਧੰਨਵਾਦ